ਬਟਰ ਚਿਕਨ ਲੱਸੀ ਛੋਲੇ ਛੋਲੇ ਭਟੂਰੇ ਪਰਾਂਠਾ ਅੰਮ੍ਰਿਤਸਰੀ ਫਿਸ਼ ਦਾਲ ਮੱਖਣੀ ਛੋਲਿਆਂ ਦੀ ਦਾਲ ਦੁੱਧ ਖੀਰ ਦਲੀਆ ਟੀਂਡੇ ਦੀ ਸਬਜ਼ੀ ਆਲੂ ਗੋਭੀ ਮਟਰ ਪਨੀਰ ਬਟਰ ਪਨੀਰ ਤੰਦੂਰੀ ਮਸਾ ਮਿਰਚ ਮਸਾਲਾ ਪਨੀਰ ਟਿੱਕਾ ਮਸ਼ਰੂਮ ਦੀ ਸਬਜ਼ੀ ਕਾਲੇ ਕੇਲੇ ਦੀ ਸਬਜ਼ੀ ਸੇਬ ਦੀ ਸਬਜ਼ੀ ਗਜਰੇਲਾ ਗੁਲਾਬ ਜਾਮਣ ਰਸਗੁੱਲਾ ਬਰਫੀ ਕੇਸਰ ਕੁਲਫੀ ਚੌਕਲੇਟ ਵਾਲੀ ਆਈਸਕ੍ਰੀਮ ਟੋਫੀ ਡੋਸਾ ਟਿੱਕੀ ਦਹੀ ਭੱਲੇ ਗੋਲ ਗੱਪੇ ਮਾਹ ਦੀ ਦਾਲ ਚਨੇ ਦੀ ਦਾਲ ਸੋਇਆ ਦਾਲ ਸਪਰਾਊਟਸ